ਹੱਥ ਤੋਂ ਬਣੇ ਹੋਏ ਕੱਪੜੇ ਅਤੇ ਰੈਡੀਮੇਡ ਕੱਪੜਿਆਂ ਵਿੱਚ ਬਹੁਤ ਫਰਕ ਹੁੰਦਾ ਹੈ ਜਿਵੇਂ ਹੱਥ ਤੋਂ ਬਣੇ ਹੋਏ ਕੱਪੜੇ ਸਿਰਫ ਹੱਥਾਂ ਨਾਲ ਹੀ ਬਣਾਏ ਜਾਂਦੇ ਹਨ ਜਦੋਂ ਕਿ ਮਸ਼ੀਨੀ ਤੌਰ 'ਤੇ ਬਣਾਏ ਜਾਣ ਵਾਲੇ ਕੱਪੜੇ ਰੈਡੀਮੇਡ ਕੱਪੜੇ ਹੁੰਦੇ ਹਨ ਜਿਨ੍ਹਾਂ ਵਿਚ ਸਿਰਫ ਜਿਨ੍ਹਾਂ ਨੂੰ ਸਿਰਫ ਮਸ਼ੀਨ ਨਾਲ ਹੀ ਬਣਾਇਆ ਜਾਂਦਾ ਹੈ ਇੱਦਾਂ ਹੀ ਅੱਜ ਕੱਲ੍ਹ ਲੋਕ ਹੱਥ ਨਾਲ ਬਣੇ ਹੋਏ ਕੱਪੜੇ ਜ਼ਿਆਦਾ ਪਸੰਦ ਕਰਦੇ ਹੈ ਜਦੋਂ ਕਿ ਬਜ਼ਾਰ ਵਿੱਚ ਰੈਡੀਮੇਡ ਕੱਪੜੇ ਬਹੁਤ ਜ਼ਿਆਦਾ ਵਿੱਕਦੇ ਹਨ ਪਰੰਤੂ ਹੱਥ ਨਾਲ ਬਣੇ ਹੋਏ ਕੱਪੜੇ ਲੋਕਾਂ ਨੂੰ ਜ਼ਿਆਦਾ ਪਸੰਦ ਆਉਂਦੇ ਹਨ ਜਿਵੇਂ ਕਿ ਫੁਲਕਾਰੀ ਜਿਸ ਜਿਸ ਦੇ ਵਿੱਚ ਕਿ ਸਿਰਫ ਹੱਥਾਂ ਨਾਲ ਹੀ ਕਢਾਈ ਕੀਤੀ ਜਾਂਦੀ ਹੈ ਅਤੇ ਉਹ ਬਹੁਤ ਹੀ ਸੋਹਣੀ ਲੱਗਦੀ ਹੈ